ਮੇਰਾ ਪ੍ਰਸ਼ਨ ਇਹ ਹੈ ਕਿ ਮੈਂ ਕੱਲ੍ਹ ਹੀ ਮੈਂ ਦੋ ਦਿਨ ਪਹਿਲਾਂ ਹੀ ਇੱਕ ਬਾਜ਼ਾਰ ਦੇ ਵਿੱਚ ਗਈ ਸੀ ਜਿੱਥੇ ਮੈਂ ਗੇਮ ਖਰੀਦਣਾ ਚਾਹੁੰਦੀ ਹਾਂ ਇਹ ਗੇਮ ਮੈਂ ਆਪਣੇ ਭਰਾ ਦੇ ਮੁੰਡੇ ਦੇ ਲਈ ਖਰੀਦਣਾ ਚਾਹੁੰਦੀ ਹਾਂ ਜੋ ਕਿ ਹਜੇ ਬਹੁਤ ਹੀ ਛੋਟਾ ਜਿਹਾ ਹੈ ਦਰਅਸਲ ਉਸਨੂੰ ਗੇਮਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਅਤੇ ਉਹ ਗੇਮਾਂ ਖੇਲਣ ਦੇ ਵਿੱਚ ਬਹੁਤ ਜ਼ਿਆਦਾ ਮਜ਼ਾ ਆਉਂਦਾ ਉਸਨੂੰ ਅਤੇ ਉਸਨੂੰ ਜ਼ਿਆਦਾਤਰ ਕਾਰਾਂ ਵਾਲੀਆਂ ਗੇਮਾਂ ਹੀ ਪਸੰਦ ਹੈ ਜੋ ਕਿ ਰਿਮੋਟ ਕੰਟਰੋਲ ਜਿਵੇਂ ਕਿ ਅੱਜ ਕੱਲ੍ਹ ਚੱਲੀਆਂ ਹੀ ਹਨ ਤੁਸੀਂ ਸਾਰੇ ਜਾਣਦੇ ਹੀ ਹੋ ਮੈਨੂੰ ਇੱਦਾਂ ਦੀ ਆਨਲਾਈਨ ਗੇਮ ਸਟੋਰ ਐਪ ਜਾਂ ਫਿਰ ਇੱਦਾਂ ਦੀ ਕੋਈ ਵੀ ਸਟੋਰ ਦਾ ਨਾਮ ਦੱਸਿਆ ਜਾਵੇ ਜਿੱਥੇ ਮੈਨੂੰ ਮੇਰੇ ਮਨ ਪਸੰਦ ਗੇਮ ਮਿਲ ਜਾਵੇ ਮੈਨੂੰ ਦਰਅਸਲ ਕਾਰ ਵਾਲੀ ਗੇਮ ਚਾਹੀਦੀ ਹੈ ਜੋ ਕਿ ਰਿਮੋਟ ਕੰਟਰੋਲ ਦੇ ਨਾਲ ਕੰਟਰੋਲ ਕੀਤੀ ਜਾਂਦੀ ਹੋਵੇ ਅਤੇ ਉਹ ਵਧੀਆ ਸਮੂਥਲੀ ਚਲਦੀ ਹੋਵੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਉਹ ਕਾਰ ਵਾਲੀ ਗੇਮ ਇੱਦਾਂ ਦੀ ਹੋਵੇ ਕਿ ਜਿਹਨੂੰ ਖੇਲ ਕੇ ਜਾਂ ਫਿਰ ਦੇਖ ਕੇ ਹੀ ਉਸਨੂੰ ਬਹੁਤ ਜ਼ਿਆਦਾ ਖੁਸ਼ੀ ਹੋਵੇ ਅਤੇ ਉਸਨੂੰ ਖੇਲਣ ਦੇ ਵਿੱਚ ਵੀ ਬਹੁਤ ਜ਼ਿਆਦਾ ਦਿਲਚਸਪੀ ਹੋਵੇ ਅਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਮੇਰਾ ਪ੍ਰਸ਼ਨ ਹੀ ਇਹ ਸੀਗਾ ਕਿ ਮੈਂ ਹਜੇ ਬਾਜ਼ਾਰ ਦੇ ਵਿੱਚ ਹੀ ਗਈ ਸੀਗੀ ਕੁਝ ਦਿਨ ਪਹਿਲਾਂ ਹੀ ਅਤੇ ਮੈਂ ਉੱਥੇ ਬਹੁਤ ਸਾਰੀਆਂ ਦੁਕਾਨਾਂ ਦੇ ਵਿੱਚ ਘੁੰਮਦੀ ਰਹੀ ਅਤੇ ਮੈਨੂੰ ਜਿੱਦਾਂ ਦੀ ਗੇਮ ਚਾਹੀਦੀ ਸੀ ਮੈਨੂੰ ਉੱਦਾਂ ਦੀ ਗੇਮ ਨਹੀਂ ਮਿਲੀ ਮੈਨੂੰ ਇੱਕ ਕਾਰ ਵਾਲੀ ਨਵੇਂ ਲੇਟੈਸਟ ਮਾਡਲ ਵਾਲੀ ਗੇਮ ਚਾਹੀਦੀ ਹੈ ਜੋ ਕਿ ਰਿਮੋਟ ਕੰਟਰੋਲਰ ਹੋਵੇ ਅਤੇ ਰਿਮੋਟ ਕੰਟਰੋਲਰ ਗੇਮਜ਼ ਮੈਨੂੰ ਉੱਥੇ ਆਸਾਨੀ ਦੇ ਨਾਲ ਮਿਲੀ ਨਹੀਂ ਅਤੇ ਜਿੱਦਾਂ ਦੀ ਮੈਨੂੰ ਮਿਲੀ ਉਹ ਗੇਮ ਮੈਨੂੰ ਪਸੰਦ ਨਹੀਂ ਆਈ ਇਸ ਕਰਕੇ ਮੈਂ ਫਿਰ ਇਹ ਈਮੇਲ ਤੁਹਾਨੂੰ ਕਰਨਾ ਚਾਹੁੰਦੀ ਹਾਂ ਕਿ ਮੈਨੂੰ ਕੋਈ ਇੱਦਾਂ ਦਾ ਆਨਲਾਈਨ ਸਟੋਰ ਦੱਸਿਆ ਜਾਵੇ ਜਿੱਥੋਂ ਦੀ ਮੈਨੂੰ ਮੇਰੇ ਮਨ ਪਸੰਦ ਗਏ ਮਿਲ ਜਾਵੇ ਅਤੇ ਉਹ ਗੇਮ ਇੱਦਾਂ ਦੀ ਹੋਵੇ ਕਿ ਜਿਹਨੂੰ ਖੇਲ ਕੇ ਜਾਂ ਫਿਰ ਦੇਖ ਕੇ ਹੀ ਮੇਰੇ ਭਰਾ ਦਾ ਮੁੰਡਾ ਬਹੁਤ ਜ਼ਿਆਦਾ ਖੁਸ਼ ਹੋ ਜਾਵੇ ਅੱਜ ਕੱਲ੍ਹ ਜਿਵੇਂ ਕਿ ਤੁਸੀਂ ਜਾਣਦੇ ਹੋ ਬੱਚਿਆਂ ਨੂੰ ਖਿਡੋਣਿਆਂ ਦਾ ਸ਼ੌਂਕ ਹੁੰਦਾ ਹੀ ਆ ਤਾਂ ਉਵੇਂ ਹੀ ਉਹਨੂੰ ਕਾਰ ਵਾਲੀ ਗੇਮਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਅਤੇ ਉਹ ਇਹੀ ਕਹਿੰਦਾ ਕਿ ਉਹ ਵੱਡਾ ਹੋ ਕੇ ਇੱਕ ਕਾਰ ਬਣਾਵੇਗਾ ਅਤੇ ਇਹ ਗੱਲਾਂ ਤਾਂ ਚਲੋ ਬਾਅਦ ਦੀਆਂ ਆ ਜਾਂਦੀਆਂ ਪਰ ਉਹਨੂੰ ਖੁਸ਼ ਕਰਨ ਦੇ ਲਈ ਮੈਂ ਉਹਨੂੰ ਇੱਕ ਵਧੀਆ ਜਿਹੀ ਕਾਰ ਵਾਲੀ ਗੇਮ ਗਿਫਟ ਕਰਨਾ ਚਾਹੁੰਦੀ ਹਾਂ ਜਿਸ ਕਰਕੇ ਮੈਨੂੰ ਇੱਦਾਂ ਦੀ ਕੋਈ ਅਲੱਗ ਅਲੱਗ ਸਟੋਰ ਜਾਂ ਆਨਲਾਈਨ ਸਟੋਰ ਇੱਦਾਂ ਦੀ ਅਗਰ ਤੁਹਾਡੀ ਨਜ਼ਰ ਦੇ ਵਿੱਚ ਹੈਗੇ ਆ ਜਿੱਥੇ ਮੈਨੂੰ ਇਹ ਮੇਰਾ ਮਨ ਪਸੰਦ ਗਿਫਟ ਮਿਲ ਜਾਵੇਗਾ ਉਹ ਮੈਨੂੰ ਈਮੇਲ ਕੀਤਾ ਜਾਵੇ ਜਾਂ ਫਿਰ ਮੈਨੂੰ ਦੱਸ ਦਿੱਤਾ ਜਾਵੇ ਮੈਂ ਆਪ ਜੀ ਦੀ ਬਹੁਤ ਜ਼ਿਆਦਾ ਧੰਨਵਾਦੀ ਹੋਵਾਂਗੀ